ਜਦੋਂ ਤੁਹਾਡੇ ਕੋਲ ਸਮਾਂ ਜਾਂ ਸਮੱਗਰੀ ਘੱਟ ਹੁੰਦੀ ਹੈ ਤਾਂ ਅਸੀਂ ਪੋਹਾ ਚਾਵਲ ਦਲੀਆ ਉਬਲੇ ਹੋਏ ਛੋਲੇ ਓਟਸ ਖਿਚੜੀ ਸੂਪ ਆਦਿ ਵਗੈਰਾ ਬਣਾ ਸਕਦੇ ਹਾਂ ਪੋਹੇ ਦੇ ਵੀ ਆਪਣੇ ਬਹੁਤ ਹੀ ਫਾਇਦੇ ਹਨ ਚਾਵਲ ਦੇ ਵੀ ਆਪਣੇ ਬਹੁਤ ਫਾਇਦੇ ਹਨ ਦਲੀਆ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਉਬਲੇ ਹੋਏ ਛੋਲੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਓਟਸ ਖਾਣ ਨਾਲ ਵੀ ਬਹੁਤ ਫਾਇਦੇ ਮਿਲਦੇ ਹਨ ਖਿਚੜੀ ਬਹੁਤ ਹਲਕਾ ਫੁਲਕਾ ਨਾਸ਼ਤਾ ਹੈ ਸੂਪ ਜੋ ਕਿ ਲੋਕ ਸਰਦੀਆਂ ਵਿੱਚ ਗਰਮੀਆਂ ਵਿੱਚ ਬਹੁਤ ਹੀ ਪਸੰਦ ਕਰਦੇ ਹਨ ਪੋਹਾ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਹ ਸਵੇਰੇ ਨਾਸ਼ਤੇ 'ਚ ਖਾਧਾ ਜਾਂਦਾ ਹੈ ਚਾਵਲ ਦਾ ਵੀ ਆਪਣਾ ਹੀ ਕੰਮ ਹੁੰਦਾ ਹੈ ਉਹ ਗਰਮੀ ਵਿੱਚ ਲੂ ਤੋਂ ਬਚਾਉਣ ਦਾ ਇੱਕ ਵਧੀਆ ਭੋਜਨ ਹੈ ਦਲੀਆ ਸਰੀਰ ਲਈ ਤਾਕਤ ਦਿੰਦਾ ਹੈ ਅਤੇ ਤਰ੍ਹਾਂ ਇਹ ਦੋ ਤਰ੍ਹਾਂ ਬਣਾਇਆ ਜਾਂਦਾ ਹੈ ਮਿੱਠਾ ਅਤੇ ਨਮਕੀਨ ਵਾਲਾ ਓਟਸ ਖਾਣ ਨਾਲ ਸਰੀਰ ਦਾ ਵਜ਼ਨ ਘੱਟ ਹੁੰਦਾ ਹੈ ਉਬਲੇ ਹੋਏ ਛੋਲੇ ਵੀ ਤਾਕਤ ਦਿੰਦੇ ਹਨ ਜੋ ਕਿ ਬਦਾਮ ਦਾ ਕੰਮ ਕਰਦੇ ਹਨ ਖਿਚੜੀ ਪੇਟ ਲਈ ਬਹੁਤ ਵਧੀਆ ਹੁੰਦੀ ਹੈ ਇਹ ਬਹੁਤ ਹੀ ਹਲਕਾ ਭੋਜਨ ਹੈ ਸੂਪ ਟਮਾਟਰ ਦਾ ਹੋਵੇ ਜਾਂ ਸਬਜ਼ੀਆਂ ਦਾ ਇਹ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਟਮਾਟਰ ਦਾ ਸੂਪ ਪੀਣ ਨਾਲ ਖੂਨ ਵੀ ਵੱਧ ਹੁੰਦਾ ਹੈ ਅਤੇ ਮੂੰਹ 'ਤੇ ਗਲੋ ਵੀ ਆਉਂਦਾ ਹੈ